ਭੰਗੜਾ ਐਰੋਬਿਕਸ ਵਿੱਚ ਨਵਾਂ ਅਤੇ ਉਤਸ਼ਾਹਜਨਕ ਫਿਟਨੈਸ ਤਰੀਕਾ ਜੋ ਪਰੰਪਰਾਗਤ ਭੰਗੜੇ ਦੀ ਤਾਕਤ ਝਟਕਿਆਂ ਅਤੇ ਨਿਰਗਮ ਦਿਲਚਸਪੀ ਨੂੰ ਆਧੁਨਿਕ ਐਰੋਬਿਕਸ ਦੀ ਵਿਗਿਆਨਿਕ ਪਦਤੀ ਨਾਲ ਜੋੜਦਾ ਹੈ ਇਹ ਕਿਸੇ ਵੀ ਉਮਰ ਜੈਵਿਕ ਯੋਗਤਾ ਜਾਂ ਤੰਦਰੁਸਤੀ ਪੱਧਰ ਲਈ ਇੱਕ ਵਧੀਆ ਵਿਕਲਪ ਹੈ ਕਿਉਂਕਿ ਇੱਕ ਨਵੇਂ ਭਾਰਤ ਚੁਸਤਤਾ ਅਤੇ ਮਾਨਸਿਕ ਤੰਦਰੁਸਤੀ ਨੂੰ ਵਿਕਸਿਤ ਕਰਦਾ ਹੈ ਭੰਗੜਾ ਐਰੋਬਿਕਸ ਦੀ ਕਲਾਸਾਂ ਦੀ ਵਾਜਣਾ ਇਕ ਨੰਬਰ ਵੈਸੇ ਭੰਗੜਾ ਐਰੋਬਿਕ ਬਿਗਨਰ ਲੈਵਲ ਜਿਹਨੂੰ ਆਪਾਂ ਇਹ ਕਲਾਸ ਸ਼ੁਰੂਆਤੀ ਵਿਅਕਤੀਆਂ ਲਈ ਹੁੰਦੀ ਆ ਜੋ ਭੰਗੜਾ ਅਤੇ ਐਰੋਬਿਕਸ ਦੀਆਂ ਮੁੱਢਲੀਆਂ ਤਕਨੀਕਾਂ ਨੂੰ ਸਿੱਖਣ ਵਿੱਚ ਇੰਝ ਲੱਗਦਾ ਹਨ ਇਸ ਵਿੱਚ ਹੌਲੀ ਹੌਲੀ ਹਲਚਲਾਂ ਆਸਾਨ ਭੰਗੜਾ ਸਟੈਪ ਸਰੀਰਕ ਲਚਕਤਾ ਅਤੇ ਕਾਰਡੀਓ ਐਕਸਰਸਾਈਜ ਸ਼ਾਮਿਲ ਕੀਤੀਆਂ ਜਾਂਦੀਆਂ ਇੱਥੇ ਵਿਅਕਤੀ ਧੀਰੇ ਧੀਰੇ ਆਪਣੇ ਸਰੀਰ ਨੂੰ ਤਿਆਰ ਕਰਦੇ ਹਨ ਅਤੇ ਅਸਾਨ ਜੰਪ ਹੱਥ ਪੈਰ ਦੀ ਗਤੀ ਅਤੇ ਬੁਨਿਆਦੀ ਸਟੈਪਾਂ ਨਾਲ ਭੰਗੜਾ ਨੂੰ ਐਰੋਬਿਕਸ ਦੇ ਅਸਲ ਰੂਪ ਨੂੰ ਸਮਝਦੇ ਹਨ ਦੂਜਾ ਨੰਬਰ ਐਰੋ ਐਂਟਰਮੀਡੀਏਟ ਭੰ ਭੰਗੜਾ ਐਰੋਬਿਕਸ ਇਹਨੂੰ ਆਪਾਂ ਇੰਗਲਿਸ਼ ਇੰਟਰਮੀਡੀਏਟ ਲੈਵਲ ਕਹਿੰਦੇ ਜਿਹਨਾਂ ਵਿਅਕਤੀਆਂ ਦੇ ਮੁੱਢਲੇ ਪੱਧਰ 'ਤੇ ਭੰਗੜਾ ਐਰੋਬਿਕਸ ਦੀ ਯਥਾਰ ਤਰੀਕੇ ਨਾਲ ਅਭਿਆਸ ਕਰ ਲਿਆ ਹੁੰਦਾ ਹੈ ਉਹ ਇੰਟਰਮੀਡੀਏਟ ਦੇ ਪੱਧਰ 'ਤੇ ਅੱਗੇ ਵਧ ਸਕਦੇ ਹਨ ਇਸ ਕਲਾਸ ਵਿੱਚ ਹਾਈ ਇੰਟੈਂਸਟੀ ਕਾਰਡੀਓ ਤੀਵਰ ਭੰਗੜਾ ਮੂਵਮੈਂਟ ਸਟੈਫਸ ਵਧਾਉਂਦੇ ਵਧਾਉਣ ਵਾਲੀਆਂ ਐਕਸਰਸਾਈਜ਼ ਅਤੇ ਕੁਝ ਜੋੜ ਮਿਲਾ ਕੀਤੇ ਜਾਣ ਵਾਲੇ ਨੱਚਣ ਵਾਲੇ ਕਸ ਅਸਰਮ ਸ਼ਾਮਿਲ ਹੁੰਦਾ ਇਸ ਪੱ ਪੱਧਰ ਸਰੀਰ ਦੀ ਚੁਸਤਤਾ ਗਤੀ ਅਤੇ ਲਚਕਤਾ ਨੂੰ ਹੋਰ ਵਧਾਉਂਦੀਆਂ ਤੀਸਰਾ ਐਡਵਾਂਸ ਭੰਗੜਾ ਐਰੋਬਿਕਸ ਇਹਨੂੰ ਆਪਾਂ ਇੰਗਲਿਸ਼ 'ਚ ਐਡਵਾਂਸ ਲੈਵਲ ਕਹਿ ਸਕਦਾ ਇਹ ਕਲਾਸ ਉਹਨਾਂ ਵਿਅਕਤੀਆਂ ਲਈ ਹੁੰਦਾ ਹੈ ਜੋ ਭੰਗੜਾ ਅਤੇ ਐਰੋਬਿਕਸ ਦੇ ਉੱਪਰ ਪੱਧਰ 'ਤੇ ਅਭਿਆਸ ਸੀ ਹਨ ਇਸ ਪੱਧਰ ਵਿੱਚ ਬਹੁਤ ਤੇਜ਼ ਭੰਗੜਾ ਸਟੈੱਪ ਬਦਸ਼ਾਲੀ ਕਾਰਡੀਓ ਵਰਕਆਊਟ ਮਜ਼ਬੂਤ ਸਰੀਰਿਕ ਟਿਕਿਓਲ ਸ਼ ਸ਼ੀਲਤਾ ਜਿਵੇਂ ਐਡਿਊਰੈਂਸ ਅਤੇ ਧਿਆਨ ਦਿੰਦੇ ਆ ਅਡਵਾਂਸ ਲੈਵਲ ਦੀ ਯੋਗਤਾ ਅਤੇ ਸਟੈਮੀਨਾ ਨੂੰ ਹੋਰ ਉੱਚ ਪੱਧਰ 'ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਪੱਧਰ ਵਿੱਚ ਵੱਡੇ ਗਤੀਵਿਧੀਆਂ ਤੀਵਰ ਜੰਪਾਂ ਅਤੇ ਉੱਚ ਸ਼ਕਤੀ ਵਾਲੇ ਨੱਚਣ ਦੇ ਢੰਗ ਸਿਖਾਏ ਜਾਂਦੇ ਹਨ ਜੋ ਕਿ ਭੰਗੜਾ ਨਿਪੁੰਨਤਾ ਅਤੇ ਐਰੋ ਐ ਐਰੋਨੈਟਿਕ ਤਾਕਤ ਨੂੰ ਹੋਰ ਨਿਵਾਉਂਦੇ ਹਨ